ਸਤਿ ਸ਼੍ਰੀ ਅਕਾਲ ਮੈਮ ਰੁਮਾਨੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਓਂ ਮੈਮ ਤੁਸੀਂ ਵਧੀਆ ਜੀ ਮੈਮ ਤੁਸੀਂ ਬਟੀਕ ਤੋਂ ਗੱਲ ਕਰਦੇ ਓਂ ਹਾਂਜੀ ਅਤੇ ਮੈਂ ਨਾ ਤੁਹਾਡੇ ਤੋਂ ਸੂਟ ਸਵਾਣਾ ਸੀਗਾ ਅਤੇ ਮੈਨੂੰ ਤੁਹਾਡਾ ਨੰਬਰ ਮਿਲਿਆ ਕਿਸੇ ਤੋਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਤੁਸੀਂ ਬਹੁਤ ਵਧੀਆ ਸੂਟ ਸਟੀਚਿੰਗ ਕਰਦੇ ਓਂ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਮੇਰਾ ਸੂਟ ਸਟਿਚ ਕਰ ਸਕਦੇ ਹੋ ਅਤੇ ਮੈਨੂੰ ਨਾ ਮਤਲਬ ਆਹੀ ਹਫ਼ਤੇ ਦੇ ਵਿੱਚ ਵਿੱਚ ਚਾਹੀਦਾ ਤੁਸੀਂ ਮੈਨੂੰ ਆਹੀ ਹਫ਼ਤੇ ਦੇ ਵਿੱਚ ਦੇਦੋਂਗੇ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੀ ਮਤਲਬ ਲੈਂਦੇ ਹੋ ਸਵਾਈ ਸੂਟਾਂ ਦੀ ਮੈਮ ਮੈਂ ਫੰਕਸ਼ਨ ਲਈ ਸੁਵਾਣਾ ਏ ਲਾਈਨਿੰਗ ਵਾਲਾ ਸੂਟ ਆ ਮੇਰਾ ਹਾਂਜੀ ਮੈਮ ਜਿਵੇਂ ਤੁਹਾਨੂੰ ਦੱਸਿਆ ਵੀ ਫੰਕਸ਼ਨ ਆ ਹੈ ਨਾ ਇੱਕ ਤਾਂ ਮੇਰਾ ਸੂਟ ਲਾਈਨਿੰਗ ਵਾਲਾ ਆ ਅਤੇ ਦੂਜਾ ਮੈਂ ਉਹਦੇ 'ਤੇ ਡਿਜ਼ਾਈਨ ਵਗੈਰਾ ਪੁਆਣੇ ਆ ਤੁਸੀਂ ਗਲੇ ਦਾ ਜਾਂ ਸਲੀਵਸ 'ਤੇ ਹੈ ਨਾ ਜਾਂ ਫਿਰ ਥੱਲੇ ਮੂਰੀਆ 'ਤੇ ਵੀ ਡਿਜ਼ਾਈਨ ਬਣਾ ਸਕਦੇ ਹੋ ਹੈ ਨਾ ਜਿਵੇਂ ਤੁਹਾਨੂੰ ਤਾਂ ਨੌਲੇਜ਼ ਹੈਗੀ ਆ ਤੁਸੀਂ ਆਪਣੇ ਹਿਸਾਬ ਨਾਲ਼ ਜਾਂ ਮੈਨੂੰ ਵਧੀਆ ਸੂਟ ਚਾਹੀਦਾ ਕਿ ਮੇਰਾ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੇ ਮੈਂ ਉਹ ਫੰਕਸ਼ਨ ਦੇ ਵਿੱਚ ਪਾਉਣਾ ਆ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਮੈਮ ਮੈਂ ਵੀਜ਼ਿਟ ਕਰ ਲਵਾਂਗੀ ਅਤੇ ਤੁਸੀਂ ਮੈਨੂੰ ਦੱਸ ਦਿਓ ਤੁਹਾਡੀ ਸ਼ੌਪ ਕਿੱਥੇ ਆ ਹਾਂਜੀ ਮੈਮ ਕਿੱਥੇ ਬਜ਼ਾਰ 'ਚ ਹਾਂਜੀ ਹਾਂਜੀ ਠੀਕ ਹੈ ਮੈਮ ਕਰ ਦਿਓ ਅਤੇ ਮੈਮ ਤੁਸੀਂ ਦੱਸ ਸਕਦੇ ਹੋ ਤੁਸੀਂ ਹੋਰ ਕਿੱਦਾਂ ਦੇ ਸੂਟ ਬਣਾਉਂਦੇ ਹੋ ਮਤਲਬ ਕੁੜਤੇ ਪਜ਼ਾਮੇ ਵਗੈਰਾ ਵੀ ਸੀ ਲੈਂਦੇ ਹੋ ਹਾਂਜੀ ਹਾਂਜੀ ਮੈਮ ਠੀਕ ਹੈ ਦੱਸ ਦਿਓ ਅਤੇ ਜੇ ਮੈਨੂੰ ਤੁਹਾਡੀ ਸਟੀਚਿੰਗ ਪਸੰਦ ਆਈ ਫਿਰ ਆਪਾਂ ਅੱਗੇ ਹੋਰ ਵੀ ਸਵਾਲਾਂਗੇ ਹੈ ਨਾ ਅਤੇ ਠੀਕ ਹੈ ਮੈਮ ਫਿਰ ਹਾਂਜੀ ਫਿਰ ਮੈਂ ਵੀਜ਼ਿਟ ਕਰਦੀ ਆ ਓਕੇ ਜੀ